ਹੈਲੋ ਹਾਂਜੀ ਸਾਬੀ ਟਰੈਵਲ ਏਜੰਸੀ ਤੋਂ ਹਾਂਜੀ ਮੈਂ ਤੁਹਾਡੀ ਗੱਡੀ ਇਨੋਵਾ ਬੁੱਕ ਕੀਤੀ ਸੀਗੀ ਹਾਂ ਮੈਂ ਉਹ ਹਿਮਾਚਲ ਜਾਣ ਲਈ ਤਾਂ ਪੱਚੀ ਤਰੀਕ ਨੂੰ ਮੈਂ ਜਾਣਾ ਸੀਗਾ ਅਤੇ ਹੁਣ ਉੱਥੇ ਕਾਫੀ ਹੜ੍ਹ ਹੁੜ੍ਹ ਆਏ ਹੋਏ ਆ ਇਸ ਕਰਕੇ ਮੇਰਾ ਮਨ ਬਦਲ ਗਿਆ ਕਿ ਮੈਂ ਨਹੀਂ ਜਾਣਾ ਹੁਣ ਜਾਣਾ ਨਹੀਂ ਚਾਹੁੰਦਾ ਹੈਗਾ ਅਤੇ ਮੈਂ ਤੁਹਾਨੂੰ ਹੈ ਨਾ ਦਸ ਹਜ਼ਾਰ ਪੇਅ ਕੀਤਾ ਸੀਗਾ ਆਪਣੀ ਟੋਟਲ ਚਾਲੀ ਹਜ਼ਾਰ ਰੁਪਏ 'ਚ ਗੱਲ ਹੋਈ ਸੀਗੀ ਅਤੇ ਮੈਂ ਤੁਹਾਨੂੰ ਦਸ ਹਜ਼ਾਰ ਪੇਅ ਕਰਤਾ ਸੀਗਾ ਅਤੇ ਹੁਣ ਸਾਡੇ ਪਰਿਵਾਰ ਦਾ ਨਹੀਂ ਜਾਣਾ ਹੈਗਾ ਪਰਿਵਾਰ ਨੇ ਪੂਰੇ ਨੇ ਅਤੇ ਕਿਉਂਕਿ ਉੱਧਰ ਹੜ੍ਹ ਆਏ ਹੋਏ ਆ ਬੱਦਲ ਫਟੇ ਹੋਏ ਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਜਾਂ ਪੈਸੇ ਵਾਪਸ ਮੋੜ ਦਿਉ ਜੇ ਤਾਂ ਤੁਸੀਂ ਕੈਸ਼ ਮੋੜਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਕੋਲ ਐਤਵਾਰ ਨੂੰ ਆ ਜਾਊਂਗਾ ਅਤੇ ਤੁਸੀਂ ਮੈਨੂੰ ਪੈਸੇ ਵਾਪਸ ਦੇ ਦਿਓ ਅਗਰ ਤੁਹਾਡਾ ਕੋਈ ਹੋਰ ਪ੍ਰੋਸੀਜ਼ਰ ਆ ਕੋਈ ਪੈਸੇ ਵਾਪਸ ਕਰਨ ਦਾ ਤਾਂ ਮੈਨੂੰ ਉਹ ਡਿਟੇਲ ਦੱਸ ਦਿਉ ਮੈਂ ਉਸ ਤਰ੍ਹਾਂ ਕੋਈ ਫਿਲ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਉਸ ਹਿਸਾਬ ਨਾਲ ਤੁਸੀਂ ਪੈਸੇ ਵਾਪਸ ਦੇ ਦਿਉ ਜੇ ਤੁਸੀਂ ਟ੍ਰਾਂਸਫਰ ਵਗੈਰਾ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਦੇ ਆ ਤਾਂ ਅਕਾਊਂਟ 'ਚ ਕਰ ਦਿਉ ਜੇ ਕੈਸ਼ ਦੇਣੇ ਆ ਕੈਸ਼ ਦੇਣੇ ਆ ਜੋ ਵੀ ਤੁਹਾਡਾ ਪ੍ਰੋਸੀਜ਼ਰ ਆ ਮੈਨੂੰ ਦੱਸ ਦਿਉ ਠੀਕ ਹੈ ਅਤੇ ਅਗਰ ਤੁਸੀਂ ਵਾਪਸ ਜਲਦੀ ਕਰ ਦੇਵੋਂਗੇ ਤਾਂ ਮੇਰੇ ਵੱਲੋਂ ਤੁਹਾਡੇ ਲਈ ਧੰਨਵਾਦ ਆ ਓਕੇ ਜੀ ਧੰਨਵਾਦ